ਵੀਹ ਦੋ ਸੌ ਸੱਠ ਪੰਜ ਹਜ਼ਾਰ ਪੰਜ ਸੌ ਵੀਹ ਚਾਲੀ ਹਜ਼ਾਰ ਪੰਜ ਸੌ ਅੱਸੀ ਨੌਂ ਲੱਖ ਪੈਂਹਟ ਹਜ਼ਾਰ ਦੋ ਸੌ ਪਚਾਸੀ